ਯੂ ਐਫ ਓ ਦਾ ਮਤਲਬ ਹੁੰਦਾ ਕਿ ਅਣਜਾਣ ਉੱਡਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਹਮੇਸ਼ਾ ਅਸਮਾਨ ਵਿੱਚ ਹੀ ਦੇਖਿਆ ਜਾਂਦਾ ਹੈ ਮਤਲਬ ਇਹ ਵੀ ਕੁਝ ਮੈਂ ਕਹਾਣੀਆਂ ਅਤੇ ਵਿਗਿਆਨੀਆਂ ਤੋਂ ਹੀ ਸੁਣਿਆ ਹੈ ਕਿ ਇਹ ਕੁਝ ਹਵਾਈ ਜਹਾਜ ਜਾਂ ਹਵਾਈ ਬਲੂਨ ਦੀ ਤਰ੍ਹਾਂ ਹੀ ਹੁੰਦੀਆਂ ਨੇ ਜੋ ਹਮੇਸ਼ਾ ਅਕਸਰ ਅਸਮਾਨ ਵਿੱਚ ਹੀ ਦੇਖੀਆਂ ਨੇ ਪਰ ਅੱਜ ਤੱਕ ਮੈਂ ਕਦੇ ਦੇਖਿਆ ਨਹੀਂ ਹਮੇਸ਼ਾ ਸੁਣਿਆ ਹੀ ਹੈ ਇਹਨਾਂ ਬਾਰੇ ਅਤੇ ਜਿੱਥੋਂ ਤੱਕ ਗ੍ਰਹਿਆਂ ਦੀ ਗੱਲ ਹੈ ਬਹੁਤ ਸਾਰੇ ਇਹੋ ਜਿਹੇ ਗ੍ਰਹਿ ਹਨ ਜਿਹਨਾਂ 'ਤੇ ਜੀਵਨ ਦੀ ਸਹਾਇਤਾ ਹੋ ਸਕਦੀ ਹੈ ਪਰ ਕੁਝ ਵਿਸ਼ੇਸ਼ ਗ੍ਰਹਿ ਜਿਹਨਾਂ ਦੀ ਮਤਲਬ ਆਪਣੀ ਜਿਹੜਾ ਮਨੁੱਖੀ ਜੀਵਨ ਹੈ ਉੱਥੇ ਸੰਭਵ ਹੈ ਜਿਵੇਂ ਕਿ ਵਿਗਿਆਨੀਆਂ ਦੀ ਖੋਜ ਦੇ ਮੁਤਾਬਕ ਮੰਗਲ ਗ੍ਰਹਿ ਉੱਤੇ ਪਾਣੀ ਦੀ ਹੋਂਦ ਆਈ ਹੈ ਤਾਂ ਉੱਥੇ ਵੀ ਜੀਵਨ ਸੰਭਵ ਹੋ ਸਕਦਾ ਹੈ ਦਿਨ ਬ ਦਿਨ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਉਵੇਂ ਉਵੇਂ ਵਿਗਿਆਨੀਆਂ ਦੀਆਂ ਖੋਜਾਂ ਅਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵੀ ਵੱਧ ਰਹੇ ਹਨ ਸ਼ਾਇਦ ਇਸ ਦੇ ਬਾਰੇ ਅਗਲੇ ਆਉਣ ਵਾਲੇ ਸਮੇਂ 'ਚੋਂ ਵੱਧ ਤੋਂ ਵੱਧ ਅਸੀਂ ਜਾਣਕਾਰੀ ਹਾਸਿਲ ਕਰ ਸਕੀਏ ਅਤੇ ਅਸੀਂ ਅ ਉੱਥੇ ਜਾ ਕੇ ਮਤਲਬ ਆਪਣਾ ਜਿਹੜਾ ਸ਼ਾਂਤਮਈ ਜੀਵਨ ਹੈ ਬਿਤਾ ਸਕੀਏ ਅਤੇ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੋਈ ਕਿ ਕਿ ਅਸੀਂ ਹੋਰਾਂ ਗ੍ਰਹਿ ਬਾਰੇ ਸੋਚਦੇ ਹਾਂ ਜਿੱਥੇ ਸਾਡਾ ਜੀਵਨ ਸੰਭਵ ਹੋ ਸਕਦਾ ਹੈ ਅਤੇ ਇਹ ਇੱਕ ਬਹੁਤ ਵੱਡੀ ਤਰੱਕੀ ਹੈ